ਇੱਕ ਨਵੰਬਰ ਉੱਨੀ ਸੌ ਸੱਤਰ ਸੱਤ ਜੁਲਾਈ ਉੱਨੀ ਸੌ ਨੱਬੇ ਸਤਾਈ ਜਨਵਰੀ ਉੱਨੀ ਸੌ ਨੜਿਨਵੇਂ ਉੱਨੀ ਮਈ ਦੋ ਹਜ਼ਾਰ ਦਸ ਛੱਬੀ ਅਗਸਤ ਦੋ ਹਜ਼ਾਰ ਵੀਹ